ਸਾਡੀ ਰਸੋਈ ਵਿੱਚ ਬਹੁਤ ਤਰ੍ਹਾਂ ਦੇ ਬਰਤਨਾਂ ਦੀ ਲੋੜ ਪੈਂਦੀ ਹੈ ਜਿਵੇਂ ਕਿ ਛੋਟੇ ਤੋਂ ਲੈ ਕੇ ਵੱਡਾ ਜੇ ਆਪਾਂ ਚਾਹ ਬਣਾਉਣੀ ਹੋਵੇ ਤਾਂ ਸਾਨੂੰ ਚਾਹ ਪੋਣੀ ਤੋਂ ਲੈ ਕੇ ਫਰਾਈਪਿਨ ਤੱਕ ਦੀ ਲੋੜ ਵੀ ਪੈਂਦੀ ਹੈ ਚਾਹ ਪੋਣੀ ਚਾਹ ਨੂੰ ਪੁੰਨਣ ਦੇ ਕੰਮ ਵਿੱਚ ਆਉਂਦੀ ਹੈ ਚਾਹ ਪੋਣੀ ਦੇ ਨਾਲ ਬੰਦਾ ਪੱਤੀ ਅਤੇ ਬਣੀ ਹੋਈ ਚਾਹ ਨੂੰ ਵੱਖ ਵੱਖ ਕਰ ਸਕਦਾ ਹੈ ਸਾਡੀ ਰਸੋਈ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕੜਾਹੀਆਂ ਵੀ ਹੁੰਦੀਆਂ ਹਨ ਵੱਡੇ ਤੋਂ ਲੈ ਕੇ ਛੋਟੀਆਂ ਜੇ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਸਬਜ਼ੀ ਭਾਜੀ ਬਣਾਉਣੀ ਹੋਵੇ ਤਾਂ ਆਪਾਂ ਵੱਡੀ ਕੜਾਹੀ ਦਾ ਵਰਤੋਂ ਕਰਦੇ ਹਾਂ ਜੇ ਆਪਾਂ ਥੋੜ੍ਹੇ ਲੋਕਾਂ ਲਈ ਬਣਾਉਣੀ ਹੋਵੇ ਤਾਂ ਆਪਾਂ ਛੋਟੀ ਕੜਾਹੀ ਦੀ ਵਰਤੋਂ ਕਰਦੇ ਹਾਂ ਅਸੀਂ ਕੜਾਹੀ ਦੇ ਵਿੱਚ ਪੂੜੀਆਂ ਵੀ ਤਲ ਸਕਦੇ ਹੈਂ ਜੇ ਆਪਾਂ ਦੁੱਧ ਉਬਾਲਣਾ ਹੋਵੇ ਤਾਂ ਉਸ ਵਿੱਚ ਪਤੀਲੇ ਦੀ ਵਰਤੋਂ ਹੁੰਦੀ ਹੈ ਅਤੇ ਅ ਸਾਡੇ ਕਿਚਨ ਦੇ ਵਿੱਚ ਅਲੱਗ ਅਲੱਗ ਪ੍ਰਕਾਰ ਦੇ ਚਮਚ ਕੜਛੀਆਂ ਪੋਣੀਆਂ ਅਤੇ ਫੋਰਕ ਵੀ ਹੁੰਦੇ ਹਨ ਫੋਰਕ ਦੇ ਨਾਲ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਫਰੂਟ ਖਾ ਸਕਦੇ ਹਾਂ ਬਰਤਨਾਂ ਨੂੰ ਧੋਣ ਵਾਸਤੇ ਕਿਚਨ ਦੇ ਵਿੱਚ ਅਲੱਗ ਤਰ੍ਹਾਂ ਦੇ ਝਾਵੇਂ ਵੀ ਹੁੰਦੇ ਹਨ ਬਰਤਨ ਨੂੰ ਢਕਣ ਵਾਸਤੇ ਇੱਕ ਸਟੀਲ ਦੀ ਜਾਲੀ ਵੀ ਆਉਂਦੀ ਹੈ